ਮੈਂ ਮਹਿੰਦੀ ਲਗਾਉਂਦੀ ਹਾਂ ਮੈਂ ਅਤੇ ਸਾਰਿਆਂ ਨੂੰ ਮੇਰੀ ਮਹਿੰਦੀ ਬਹੁਤ ਪਸੰਦ ਹੈ ਮੈਨੂੰ ਬਚਪਨ ਤੋਂ ਹੀ ਮਹਿੰਦੀ ਲਾਉਣ ਦਾ ਸ਼ੌਕ ਸੀਗਾ ਮੈਂ ਪਹਿਲਾਂ ਪੇਜਾਂ 'ਤੇ ਡਰੋਅ ਕਰਦੀ ਸੀਗੀ ਅਤੇ ਫਿਰ ਉਸ ਨੂੰ ਆਪਣੀ ਮਹਿੰਦੀ ਦੇ ਨਾਲ਼ ਡਰੋਅ ਕਰਦੀ ਸੀਗੀ ਪੇਜ਼ਿਸ 'ਤੇ ਅਤੇ ਹੌਲੀ ਹੌਲੀ ਮਤਲਬ ਮੈਂ ਪਹਿਲਾਂ ਆਪਣੇ ਘਰ ਹੀ ਆਪਣੇ ਹੱਥਾਂ 'ਤੇ ਲਗਾਉਂਦੀ ਸੀਗੀ ਅਤੇ ਫਿਰ ਮੈਂ ਆਪਣੀ ਮੰਮੀ ਨਾ ਦੇ ਹੱਥਾਂ 'ਤੇ ਲਗਾਉਣ ਲੱਗੀ ਹੌਲੀ ਹੌਲੀ ਫਿਰ ਮੈਨੂੰ ਪਿੰਡ ਦੇ ਆਂਟੀਆਂ ਬੁਲਾ ਕੇ ਲੈ ਕੇ ਜਾਣ ਲੱਗ ਗਈਆਂ ਕਿ ਸਾਡੇ ਮਹਿੰਦੀ ਲਗਾ ਦੇ ਸਾਡੇ ਮਹਿੰਦੀ ਲਗਾ ਦੇ ਫਿਰ ਹੌਲ਼ੀ ਹੌਲ਼ੀ ਮਤਲਬ ਲੋਕਾਂ ਨੂੰ ਪਤਾ ਲ ਲੱਗਣ ਲੱਗ ਗਿਆ ਫਿਰ ਮਤਲਬ ਆਂਟੀਆਂ ਅੱਗੇ ਅਤੇ ਅੱਗੇ ਦੱਸਣ ਲੱਗ ਗਈਆਂ ਅਤੇ ਇੱਕ ਦਿਨ ਮਤਲਬ ਇੱਕ ਬਰਾਈਡਲ ਦੇ ਵੀ ਮਹਿੰਦੀ ਲਗਾਈ ਤਾਂ ਉਹਨਾਂ ਨੂੰ ਮਤਲਬ ਕਿ ਲੋਕਾਂ ਨੇ ਦੇਖਿਆ ਕਿ ਬਹੁਤ ਸੋਹਣੀ ਮਹਿੰਦੀ ਲਗਾਈ ਹੈ ਫਿਰ ਮੈਨੂੰ ਮਤਲਬ ਕਿ ਜਿਹੜੀ ਪਾਰਲਰ ਵਾਲੀ ਸੀਗੀ ਇੱਕ ਉਹਨੇ ਮੈਨੂੰ ਆਪਣੇ ਨਾਲ਼ ਰੱਖ ਲਿਆ ਕਿ ਤੂੰ ਆਪਾਂ ਕਮਿਸ਼ਨ ਕਰਲਵਾਂਗੇ ਕਿ ਤੂੰ ਅਪ ਮੇਰੇ ਨਾਲ਼ ਜਿਹੜੀ ਬਰਾਈਡਲਜ਼ 'ਤੇ ਮਹਿੰਦੀ ਲਗਾ ਦਿਆ ਕਰੀਂ ਇਸ ਤਰ੍ਹਾਂ ਮੈਂ ਆਪਣਾ ਜਿਹੜਾ ਮਹਿੰਦੀ ਦੀ ਕਲਾ ਨਾਲ਼ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਮੈਂ ਅੱਜ ਮਹਿੰਦੀ ਦੀ ਕਲਾ ਨਾਲ਼ ਪੈਸੇ ਵੀ ਕਮਾ ਰਹੀ ਹਾਂ